ਇੱਕ ਚੰਗੀ ਫੋਟੋ ਖਿੱਚਣ ਲਈ ਰੋਸ਼ਨੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਕਿਉਂਕਿ ਦਿਨ ਦੀ ਜਦੋਂ ਫੋਟੋ ਖਿੱਚੋ ਰਾਤ ਦੀ ਫੋਟੋ ਖਿੱਚੋ ਬਹੁਤ ਹੀ ਦੋਨਾਂ ਵਿੱਚ ਅਲੱਗ ਹੀ ਇੱਕ ਡਿਫਰੈਂਸ ਹੁੰਦਾ ਇਸ ਲਈ ਜਦੋਂ ਸਵੇਰ ਵੇਲੇ ਆਪਾਂ ਫੋਟੋ ਖਿੱਚਦੇ ਹਾਂ ਅਤੇ ਜਿੱਦਾਂ ਕਿ ਸੂਰਜ ਦੀ ਰੋਸ਼ਨੀ ਹਮੇਸ਼ਾ ਕੈਮਰੇ ਦੇ ਅੱਗੇ ਹੋਣੀ ਚਾਹੀਦੀ ਹੈ ਨਾ ਕਿ ਪਿੱਛੇ ਹੋਣੀ ਚਾਹੀਦੀ ਜਿਹਦੀ ਫੋਟੋ ਖਿੱਚ ਰਹੇ ਹਾਂ ਉੱਥੇ ਰੋਸ਼ਨੀ ਉੱਥੇ ਸੂਰਜ ਦੀ ਰੋਸ਼ਨੀ ਦਾ ਉੱਥੇ ਰੋਸ਼ਨੀ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਕੈਮਰੇ ਦੇ ਪਿੱਛੇ ਅਗਰ ਤੁਹਾਡੀ ਰੋਸ਼ਨੀ ਹੋਊਗੀ ਤਾਂ ਤੁਸੀਂ ਫੋਟੋ ਸਹੀ ਤਰ੍ਹਾਂ ਨਹੀਂ ਖਿੱਚ ਪਾਓਂਗੇ ਅਗਰ ਸਾਹਮਣੇ ਹੋਊਗੀ ਤਾਂ ਬਹੁਤ ਵਧੀਆ ਫੋਟੋ ਖਿੱਚ ਪਾਓਂਗੇ ਇੱਦਾਂ ਹੀ ਰਾਤ ਦੀ ਰੋਸ਼ਨੀ ਜਿਹੜੀ ਲਾਈਟਸ ਹੁੰਦੀ ਆ ਉਹ ਸਾਹਮਣੇ ਬੰਦੇ ਦੇ ਪੈਣੀ ਚਾਹੀਦੀ ਆ ਨਾ ਕਿ ਕੈਮਰੇ ਦੇ ਪਿੱਛੇ ਪੈਣੀ ਚਾਹੀਦੀ ਹੈ ਤਾਂ ਕਰਕੇ ਰਾਤ ਨੂੰ ਫੋਟੋ ਖਿੱਚੀ ਤਾਂ ਜਿਹੜੀ ਰੋਸ਼ਨੀ ਦਾ ਉਹ ਅਲੱਗ ਹੀ ਚੀਜ਼ ਹੁੰਦੀ ਹੈ ਅਤੇ ਉਸ ਹਮੇਸ਼ਾ ਫੋਟੋ ਖਿੱਚਣ ਵਾਲੇ ਦੇ ਸਾਹਮਣੇ ਉੱਥੇ ਹੀ ਪੈਣੀ ਚਾਹੀਦੀ ਹੈ ਕਿਉਂਕਿ ਕੈਮਰੇ ਦੇ ਪਿੱਛੇ ਫੋਟੋ ਫੋਟੋ ਖਿੱਚੋਗੇ ਤਾਂ ਸਹੀ ਤਰ੍ਹਾਂ ਤੁਸੀਂ ਫੋਟੋ ਨਹੀਂ ਖਿੱਚ ਪਾਓਂਗੇ ਇਸ ਲਈ ਫੋਟੋ ਖਿੱਚਣ ਲਈ ਰੋਸ਼ਨੀ ਦਾ ਸਹੀ ਤਰੀਕੇ ਦੇ ਨਾਲ ਪੈਣਾ ਬਹੁਤ ਵੱਡੀ ਚੀਜ਼ ਹੁੰਦੀ ਹੈ ਤਾਂ ਹੀ ਇੱਕ ਬਹੁਤ ਵੱਡੀ ਵਧੀਆ ਫੋਟੋ ਖਿੱਚ ਪਾਓਗੇ ਤੁਸੀਂ